ਅੱਜ ਕੱਲ੍ਹ ਦੇ ਸਮੇਂ ਵਿੱਚ ਨਵੇਂ ਜੰਮੇ ਬੱਚਿਆਂ ਨੂੰ ਬਿਮਾਰੀਆਂ ਬਹੁਤ ਛੇਤੀ ਲੱਗਦੀਆਂ ਹਨ ਇਸ ਦਾ ਇੱਕੋ ਹੀ ਕਾਰਨ ਹੈ ਕਿ ਆਪਣਾ ਵਾਤਾਵਰਨ ਸ਼ੁੱਧ ਨਹੀਂ ਹੈ ਆਪਣਾ ਆਲਾ ਦੁਆਲਾ ਸਾਫ ਨਹੀਂ ਹੈ ਪਹਿਲੇ ਦੇ ਸਮਿਆਂ ਵਿੱਚ ਇਹ ਹੁੰਦਾ ਸੀ ਕਿ ਬੱਚਿਆਂ ਦਾ ਜਨਮ ਘ ਘਰ ਵਿੱਚ ਹੀ ਹੁੰਦਾ ਸੀ ਜਿਸ ਨਾਲ ਉਹ ਬਾਹਰਲੀਆਂ ਇਨਫੈਕਸ਼ਨ ਨਾਲ ਬਾਹਰਲੀਆਂ ਬਿਮਾਰੀਆਂ ਨਾਲ ਇੰਨੇ ਸੰਪਰਕ ਵਿੱਚ ਨਹੀਂ ਸੀ ਅੱਜ ਕੱਲ੍ਹ ਹੁਣ ਹਸਪਤਾਲ ਸ਼ੁਰੂ ਹੋ ਗਏ ਹਸਪਤਾਲਾਂ ਵਿੱਚ ਡਿਲੀਵਰੀਆਂ ਹੋਣ ਲੱਗ ਗਈਆਂ ਤਾਂ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿੱਥੇ ਘਰਦੇ ਡਿਲੀਵਰੀ ਕਰਵਾ ਰਹੇ ਜਿਹੜੇ ਹਸਪਤਾਲ ਵਿੱਚ ਉੱਥੋਂ ਦਾ ਹਸਪਤਾ ਉ ਉਸ ਹਸਪਤਾਲ ਵਿੱਚ ਸਾਫ ਸਫਾਈ ਦਾ ਧਿਆਨ ਰੱਖਿਆ ਜਾਂਦਾ ਹੋਵੇ ਉੱਥੋਂ ਦਾ ਸਟਾਫ ਚੰਗੀ ਤਰ੍ਹਾਂ ਸਾਫ ਸੁਥਰੇ ਤਰੀਕੇ ਨਾਲ ਕੰਮ ਕਰਦਾ ਹੋਵੇ ਅਤੇ ਉਸ ਸਮੇਂ ਦੇਖ ਲੈਣਾ ਚਾਹੀਦਾ ਹੈ ਕਿ ਬੱਚੇ ਨੂੰ ਕੋਈ ਬਿਮਾਰੀ ਤਾਂ ਨਹੀਂ ਸ਼ੁਰੂ ਤੋਂ ਜੇ ਬਿਮਾਰੀ ਹੈ ਤਾਂ ਉਸਦਾ ਇਲਾਜ ਵੀ ਸਮੇਂ ਸਿਰ ਹੋ ਜਾਣਾ ਚਾਹੀਦਾ ਸ਼ੁਰੂ ਹੋ ਜਾਣਾ ਚਾਹੀਦਾ ਹੈ ਅਤੇ ਜਦੋਂ ਬੱਚਾ ਜੱਚਾ ਬੱਚਾ ਘਰ ਆਉਂਦੇ ਹਨ ਤਾਂ ਉਸ ਚੀਜ਼ ਦਾ ਵੀ ਧਿਆਨ ਰੱਖਿਆ ਜਾਵੇ ਕਿ ਘਰ ਵਿੱਚ ਪੂਰੀ ਸਾਫ ਸਫਾਈ ਹੋਵੇ ਸਪੈਸ਼ਲ ਉਹਨਾਂ ਦੇ ਜਿਹੜੇ ਕਮਰੇ ਵਿੱਚੋਂ ਜਾ ਰਹੇ ਆ ਉੱਥੋਂ ਦੀ ਸਾਫ ਸਫਾਈ ਹੋਵੇ ਉੱਥੋਂ ਦਾ ਵਾਤਾਵਰਨ ਸਾਫ ਹੋਵੇ ਉਹ ਤਾਂ ਕਿ ਜਿਹੜੀ ਵੀ ਕੋਈ ਵੀ ਉੱਥੇ ਇਨਫੈਕਸ਼ਨ ਵਗੈਰਾ ਹੋਊਗੀ ਜਾਂ ਕੋਈ ਵੀ ਚੀਜ਼ ਹੋਊਗੀ ਉਹ ਨਾ ਹੋਵੇ ਜੇਕਰ ਉਸ ਕਮਰੇ ਵਿੱਚ ਮੱਛਰ ਵਗੈਰਾ ਹੈਗੇ ਆ ਕੁਛ ਵੀ ਤਾਂ ਸਪਰੇ ਵਗੈਰਾ ਕਰਵਾ ਕੇ ਪਹਿਲਾਂ ਹੀ ਉਸ ਕਮਰੇ ਨੂੰ ਸਾਫ ਸੁਥਰੇ ਤਰੀਕੇ ਨਾਲ ਤਿਆਰ ਕਰ ਲੈਣ ਅਤੇ ਸਾਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਬਾਹਰਲੇ ਲੋਕ ਆ ਕੇ ਮਿਲਦੇ ਹਨ ਉਹਨਾਂ ਨਾਲ ਦੂਰੀ ਬਣਾਈ ਦੂਰੀ ਬਣਾਈ ਜਾ ਸਕੇ ਕਿ ਮਲ ਜੇ ਬਾਹਰਲੀਆਂ ਅੱਜ ਕੱਲ੍ਹ ਬਹੁਤ ਇਨਫੈਕਸ਼ਨ ਵੱਧ ਗਈਆਂ ਮਲੇਰੀਆ ਵਗੈਰਾ ਯੇਹ ਵੋਹ ਜ ਜਿਹੜੀਆਂ ਬਿਮਾ ਬਿਮਾਰੀਆਂ ਜਿਹੜੇ ਬਾਹਰਲੇ ਲੋਕ ਆ ਉਹ ਘੱਟ ਆ ਕੇ ਮਿਲਣ ਕਿ ਜਿਹੜਾ ਜੱਚਾ ਬੱਚਾ ਉਹ ਬਾਹਰਲੀਆਂ ਇਨਫੈਕਸ਼ਨ ਨਾਲ ਉਹਨਾਂ ਦੇ ਘੱਟ ਸੰਪਰਕ ਵਿੱਚ ਆਉਣ ਅਤੇ ਆਪਾਂ ਨੂੰ ਇਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ ਕਿ ਜਿਹੜੇ ਬੱਚੇ ਨੂੰ ਨਵੇਂ ਕੱਪੜੇ ਨਾ ਪਹਿਨਾਏ ਜਾਣ ਉਹਨੂੰ ਪੁਰਾਣੇ ਕ ਕੱਪੜੇ ਹੀ ਪਹਿਨਾਏ ਜਾਣ ਜਿਹੜੇ ਕਿ ਸਾਫ ਸੁਥਰੇ ਹੋਣ ਚੰਗੀ ਤਰ੍ਹਾਂ ਸਾਫ ਕੀਤੇ ਹੋਣ ਅਤੇ ਮੁਲਾਇਮ ਹੋਣ ਅਤੇ ਸਾਨੂੰ ਇਸ ਚੀਜ਼ ਦਾ ਧਿਆਨ ਵੀ ਰੱਖਣਾ ਚਾਹੀਦਾ ਹੈ ਕਿ ਬਾਹਰਲੇ ਲੋਕ ਆ ਕੇ ਨਾ ਮਿਲਣ ਧੰਨਵਾਦ